ਹੈਲੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਖੇਤੀਬਾੜੀ ਖੇਤੀਬਾੜੀ ਵਿਭਾਗ ਤੋਂ ਬੋਲਦੇ ਜੀ ਹਾਂਜੀ ਆਪਾਂ ਨੇ ਨਾ ਉਹ ਕਣਕ ਦੀ ਆਪਣੀ ਫਸਲ ਵੱਢੀ ਤੀ ਹੁਣ ਉਹਦੀ ਜਿਹੜੀ ਪਰਾਲੀ ਹੈ ਉਹਨੂੰ ਮਿੱਟੀ 'ਚ ਮਿਲਾਉਣ ਵਾਸਤੇ ਕਿਹੜੀ ਮਸ਼ੀਨ ਵਧੀਆ ਰਹੇਗੀ ਅੱਛਾ ਜੀ ਅੱਛਾ ਜੀ ਅੱਛਾ ਜੀ ਕਆ ਕਆ ਫ਼ਾਇਦੇ ਕਆ ਕਆ ਲੈ ਸਕਦੇ ਆਪਾਂ ਇਹਦੇ ਜੀ ਅੱਛਾ ਜੀ ਅੱਛਾ ਜੀ ਬਕ ਅੱਛਾ ਜੀ ਆਪਾਂ ਤਾਂ ਵਰਤੋਂ ਵਿੱਚ ਆ ਸਕਦੀ ਆ ਅੱਛਾ ਜੀ ਇੱਕ ਜੇ ਆਪਾਂ ਹੋਰ ਕਿਹੜਾ ਕਿਹੜਾ ਸੰਦ ਹੈ ਆਪਣੇ ਕੋਲ ਜੀ ਆਹ ਸੁਪਰ ਸੀਡਰ ਵਾਲ਼ਾ ਕਆ ਕੰਮ ਹੈ ਜੀ ਆਪਣੇ ਕੋਲ ਸੁਪਰ ਸੀਡਰ ਵਾਲ਼ਾ ਕਆ ਕੰਮ ਹੈ ਜੀ ਆਪਣੇ ਕੋਲ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡ ਬਾਕੀ ਇਹਦੇ ਕੰਮ ਇਹਦੇ ਵੀ ਆਪਾਂ ਕੰਮ ਲੈ ਸਕਦੇ ਇਹਦੇ ਇਹਦੇ ਕੰਮ ਅੱਛਾ ਜੀ ਅੱਛਾ ਜੀ ਅੱਛਾ ਸਾਡੇ ਕੋਲ ਹੈਗੇ ਦਸ ਕੁ ਕਿੱਲੇ ਜੀ ਅਤੇ ਟ੍ਰੈਕਟਰ ਵੀ ਹੈਗਾ ਜੀ ਆਪਣਾ ਅੱਛਾ ਜੀ ਜਿਵੇਂ ਮਤਲਬ ਜਿੰਨੀ ਟ੍ਰੈਕਟਰ ਦੀ ਹੋਸ ਪਾਵਰ ਹੈ ਜੀ ਉਹਦੇ ਹਿਸਾਬ ਨਾਲ ਤਿਆਰ ਕਰਕੇ ਦੇਵੋਂਗੇ ਤੁਸੀਂ ਅੱਛਾ ਜੀ ਮਤਲਬ ਇਹਦੇ ਵਿੱਚ ਆਪਾਂ ਕੰਮ ਮਤਲਬ ਜਿਸ ਤਰ੍ਹਾਂ ਹੁਣ ਇੱਕ ਜਿਸ ਤਰ੍ਹਾਂ ਕਣਕ ਬੀਜਣੀ ਹੈ ਅਤੇ ਬਾਕੀ ਕੰਮ ਵੀ ਡਰਿੱਲ ਹੋਰ ਵੀ ਫਿੱਟ ਜਗ੍ਹਾ ਬਦਲ ਕੇ ਫਿੱਟ ਕਰ ਸਕਦੇ ਇਹਦੇ ਅੱਛਾ ਜੀ ਮਤਲਬ ਇਹਦੇ ਇਸ ਤੋਂ ਲੈ ਸਕਦੇ ਆਪਾਂ ਸਾਰੇ ਕੰਮ ਜੀ ਓਕੇ ਜੀ ਔਕ